ਜੀ ਮੈਂ ਬਿਲਕੁਲ ਸਹਿਮਤ ਹਾਂ ਜੀ ਟੈਕਨੋਲਜੀ ਸਾਰੇ ਰਹਿਣ ਦੇ ਤਰੀਕੇ ਨੂੰ ਬਦਲ ਰਹੀ ਹੈ ਜੋ ਅਸੀਂ ਸੋਚਦੇ ਹਾਂ ਜਿੱਥੇ ਅਸੀਂ ਕੋਈ ਵੀ ਚੀਜ਼ ਅਗਰ ਅਸੀਂ ਟੈਕਨੋਲਜੀ ਬਾਰੇ ਗੱਲ ਕਰੀਏ ਜਾਂ ਅਸੀਂ ਕੋਈ ਵੀ ਅ ਅੱਜ ਦੀ ਡੇਟ ਦੇ ਅੰਦਰ ਟੈਕਨੋਲਜੀ ਦੀ ਗੱਲ ਕਰ ਰਹੇ ਹਾਂ ਅਤੇ ਇੰਟਰਨੈੱਟ ਇੱਕ ਇੱਦਾਂ ਦਾ ਸ ਇੱਕ ਸਾਧਨ ਬਣ ਚੁੱਕਿਆ ਹੈ ਕਿ ਹਰ ਘਰ ਘਰ ਦੇ ਅੰਦਰ ਇੰਟਰਨੈੱਟ ਅਵੇਲੇਬਲ ਹੈ ਉਹ ਟੈਕਨੋਲਜੀ ਨੂੰ ਅਸੀਂ ਇੱਦਾਂ ਯੂਜ ਕਰ ਸਦਕੇ ਹਾਂ ਜਿੱਦਾਂ ਅਸੀਂ ਈ ਕਮਰਸ ਦੀ ਗੱਲ ਕਰਦੇ ਹਾਂ ਇਲੈਕਟ੍ਰੋਨਿਕ ਜਿਹੜੀਆਂ ਕਹਿ ਸਕਦੇ ਹਾਂ ਸੁਵਿਧਾਵਾਂ ਨੇ ਸਾਡੇ ਕੋਲ ਉਹਦੇ ਥਰੂ ਅਸੀਂ ਸ਼ੋਪਿੰਗ ਕਰ ਰਹੇ ਹਾਂ ਜਾਂ ਅਸੀਂ ਮੈਸਿਜ ਭੇਜ ਰਹੇ ਹਾਂ ਅਤੇ ਨਾਲ ਨਾਲ ਹੀ ਅਸੀਂ ਕੋਈ ਵੀ ਚੀਜ਼ ਨੂੰ ਲਾਈਵ ਗੱਲਾਂ ਕਰ ਸਕਦੇ ਹਾਂ ਵੀਡੀਓ ਕੋਲ ਕਰ ਸਕਦੇ ਹਾਂ ਇਹ ਬਹੁਤ ਅੱਜ ਦੀ ਡੇਟ 'ਚ ਜ਼ਰੂਰੀ ਚੀਜ਼ਾਂ ਬਣ ਚੁੱਕੀਆਂ ਨੇ ਅਤੇ ਟੈਕਨੋਲਜੀ ਇੰਨੀ ਅੱਗੇ ਚਲੀ ਗਈ ਹੈ ਕਿ ਬੈਟਰੀ ਜਿਹੜੀ ਹੈਗੀਆਂ ਨੇ ਅੱਜ ਕੱਲ੍ਹ ਈ ਵੇਹੀਕਲ ਆ ਗਏ ਨੇ ਇੰਜਣ ਦਾ ਕੰਮ ਖਤਮ ਹੋ ਗਿਆ ਹੁਣ ਅਤੇ ਸਾਰਾ ਕੁਛ ਬੈਟਰੀ ਨਾਲ ਹੀ ਚੱਲ ਰਿਹਾ ਹੈ ਹੈਤੇ ਟੈਕਨੋਲਜੀ ਡੇਅ ਬਾਏ ਡੇਅ ਬਹੁਤ ਵੱਧ ਰਹੀ ਹੈ ਅਤੇ ਮੈਂ ਇਸ ਚੀਜ਼ ਨੂੰ ਇਹ ਸਾਡੇ ਜੀਵਨ ਨੂੰ ਵੀ ਬਦਲਾਅ ਹੋ ਰਿਹਾ ਰਹਿਣ ਦਾ ਤਰੀਕਾ ਵੀ ਬਦਲ ਰਿਹਾ ਸਾਡਾ ਅਤੇ ਵਾਤਾਰਵਾਨ ਵਾਤਾਰਨ ਜਿਹੜੇ ਵਾਤਾਵਰਨ ਨਾਲ ਨਾਲ ਸਾਡੀ ਗੱਲ ਬਾਤ ਬਿਲਕੁਲ ਹੋ ਰਹੀ ਹੈ ਜਿੱਦਾਂ ਅਸੀਂ ਦੇਖ ਰਹੇ ਹਾਂ ਗਲੋਬਲ ਚੈਲੇਂਜ ਜਿਹੜਾ ਹੈਗਾ ਹੈ ਉਹ ਵੀ ਥੋੜ੍ਹਾ ਹੈ ਜ਼ਰੂਰ ਹੈ ਲੇਕਿਨ ਕਿੱਥੇ ਨਾ ਕਿਤੇ ਈਕੋ ਫਰੈਂਡਲੀ ਬੈਟਰੀਜ ਵੀ ਬਣ ਚੁੱਕੀਆਂ ਨੇ